ਸਿਲਾਈ ਲਈ ਵਰਤੇ ਜਾਂਦੇ ਵੱਖ ਵੱਖ ਧਾਗੇ ਅਤੇ ਉਹਨਾਂ ਦੀਆਂ ਖ਼ਾਸੀਅਤਾਂ ਬਹੁਤ ਤਰੀਕੇ ਦੀਆਂ ਹੁੰਦੀਆਂ ਹਨ ਜਿਵੇਂ ਕਿ ਸਿਲਾਈ ਵਿੱਚ ਵਰਤੇ ਜਾਣ ਵਾਲੇ ਧਾਗੇ ਕੱਪੜੇ ਦੀ ਕਿਸਮ ਲਚਕਤਾ ਮਜ਼ਬੂਤੀ ਅਤੇ ਟਿਕਾਊਪਨ ਦੇ ਅਧਾਰ 'ਤੇ ਵੱਖ ਵੱਖ ਕਿਸਮਾਂ ਦੇ ਹੁੰਦੇ ਹਨ ਕੁਛ ਮੁੱਖ ਧਾਗੇ ਇਸ ਤਰੀਕੇ ਦੇ ਹੁੰਦੇ ਹਨ ਜਿਵੇਂ ਕਿ ਕਪਾਹ ਦਾ ਧਾਗਾ ਇਹਦੀਆਂ ਕੁਛ ਖ਼ਾਸੀਅਤਾਂ ਇਹ ਹੁੰਦੀਆਂ ਨੇ ਇਹ ਕਿ ਕੁਦਰਤੀ ਧਾਗਾ ਹਲਕਾ ਅਤੇ ਸੌਖਾ ਹੁੰਦਾ ਹੈ ਵਰਤੋਂ ਕਪਾਹ ਰੇਸ਼ਮ ਅਤੇ ਹਲਕੀਆਂ ਕੱਪੜਿਆਂ ਦੀ ਸਿਲਾਈ ਵਿੱਚ ਇਹ ਕੰਮ ਦਾ ਹੁੰਦਾ ਹੈ ਹੱਥ ਦੀ ਸਿਲਾਈ ਅਤੇ ਐਮਬਰਾਇਡਰੀ ਵਿੱਚ ਵੀ ਇਹ ਮਦਦ ਕਰਦਾ ਹੈ ਇੱਕ ਹੋਰ ਧਾਗਾ ਹੈ ਜਿਵੇਂ ਕੀ ਪੋਲੀਏਸਟਰ ਦਾ ਧਾਗਾ ਇਹਦੀਆਂ ਖ਼ਾਸੀਅਤਾਂ ਇਹ ਹੁੰਦੀਆਂ ਹਨ ਇਹ ਕਿ ਮਜ਼ਬੂਤ ਅਤੇ ਕਿਸਾਈ ਪ੍ਰਤੀਰੋਧਕ ਪਾਣੀ ਅਤੇ ਰਸਾਇਣਕ ਪ੍ਰਤੀਰੋਧਕ ਤੋਂ ਬਚਾ ਰੱਖਦਾ ਹੈ ਵਰਤੋਂ ਇਹ ਡੈਨੀਮ ਬੈਗਸ ਜੀਨਜ ਅਤੇ ਹੈਵੀ ਡਿਊਟੀ ਮਸ਼ੀਨ ਸਿਲਾਈ ਵਿੱਚ ਕੰਮ ਆਉਂਦਾ ਹੈ ਘਰ ਵਿੱਚ ਆਮ ਕੱਪੜਿਆਂ ਦੀ ਸਿਲਾਈ ਇਸਦੇ ਇਸਦੇ ਥਰੂ ਹੀ ਹੁੰਦੀ ਹੈ ਨਾਈਲਨ ਦਾ ਧਾਗਾ ਇਹ ਧਾਗਾ ਬਹੁਤ ਲਚਕਦਾਰ ਆਸਾਨੀ ਨਾਲ ਨਾ ਟੁੱਟਣ ਵਾਲਾ ਪਾਣੀ ਪ੍ਰਤੀਰੋਧਕ ਅਤੇ ਕਿਸਾਈ ਪ੍ਰਤੀਰੋਧਕ ਧਾਗਾ ਹੁੰਦਾ ਹੈ ਰੇਸ਼ਮ ਦਾ ਧਾਗਾ ਇਹ ਧਾਗਾ ਬਹੁਤ ਨਰਮ ਚਮਕਦਾਰ ਅਤੇ ਮਜ਼ਬੂਤ ਧਾਗਾ ਹੁੰਦਾ ਹੈ ਆਸਾਨੀ ਨਾਲ ਗੱਠ ਨਹੀਂ ਬਣਾਉਂਦਾ ਧਾਗਾ ਰੇਸ਼ਮ ਦੇ ਕੱਪੜਿਆਂ ਲਈ ਆਦਰਸ਼ ਹੁੰਦਾ ਹੈ